ਮੈਂ ਇੱਥੇ ਨਾ ਪ੍ਰੋਗਰਾਮਿੰਗ ਦੀ ਕਿਤਾਬ ਪਰਚੇਜ਼ ਕੀਤੀ ਟਾਟਾ ਮੈਗਰਾ ਹਿੱਲ ਦੀ ਪਬਲੀਕੇਸ਼ਨ ਹੈਗੀ ਆ ਮੈਨੂੰ ਇਵੇਂ ਸੀ ਕਿ ਇਹ ਬਹੁਤ ਵਧੀਆ ਕਿਤਾਬ ਹੋਊਗੀ ਪਬਲੀਕੇਸ਼ਨ ਬਹੁਤ ਵਧੀਆ ਸਟੈਂਡਰਡ ਦਾ ਪਬਲੀਸ਼ਰ ਹੈਗਾ ਬਟ ਬੜੀ ਹੈਰਾਨੀ ਅਤੇ ਦੁੱਖ ਦੀ ਗੱਲ ਇਹ ਹੈਗੀ ਆ ਕਿ ਉਹਦੇ ਗਰਾਮੈਟੀਕਲੀ ਟੈਕਨੀਕਲ ਇੰਨੀਆਂ ਗ਼ਲਤੀਆਂ ਨੇ ਉਹਦੇ 'ਚ ਜਿਵੇਂ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਕਿਸੇ ਚੰਗੇ ਪੇਪਰ 'ਤੇ ਪਬਲਿਸ਼ ਨਹੀਂ ਹੋਈ ਹੈਗੀ ਬੁੱਕ ਦਾ ਜਿਹੜਾ ਕਵਰ ਹੈਗਾ ਉਹ ਬਹੁਤ ਘਟੀਆ ਹੈਗਾ ਟੈਕਨੀਕਲੀ ਜਿਹੜੀਆਂ ਇਲੈਸਟ੍ਰੇਸ਼ਨਸ ਹੈਗੀਆਂ ਨੇ ਉਹ ਉਹਦੇ 'ਚ ਬਿਲਕੁਲ ਨਹੀਂ ਦਿੱਤੀਆਂ ਹੋਈਆਂ ਹੈਗੀਆਂ ਜਿੰਨੀਆਂ ਐਗਜਾਂਪਲਜ਼ ਹੈਗੀਆਂ ਨੇ ਉਹ ਬਹੁਤ ਘੱਟ ਨੇ ਉਹਦੇ 'ਚ ਅਤੇ ਕੋਈ ਵੀ ਇਮੇਜ਼ਿਸ ਜਿਹੜੀਆਂ ਹੈਗੀਆਂ ਨੇ ਫੋਟੋਆਂ ਕਿਸੇ ਵੀ ਉਹਦੇ ਟੈਕਨੀਕਲ ਪ੍ਰੋਗਰਾਮ ਦੀਆਂ ਨਹੀਂ ਦਿੱਤੀਆਂ ਗਈਆਂ